ਇੱਕ ਬਾਈਕਰ ਵਜੋਂ ਤੁਹਾਨੂੰ ਕਿਹੜੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਤੁਸੀਂ ਉਹਨਾਂ ਨੂੰ ਕਿਵੇਂ ਦੂਰ ਕਰ ਸਕਦੇ ਹੋ ਸਾਨੂੰ ਖ਼ਰਾਬ ਟਰੈਫਿਕ ਬਹੁਤ ਮਿਲਦਾ ਹੈ ਜਿਹਦੇ ਕਾਰਨ ਅਸੀਂ ਕਿੱਥੇ ਵੀ ਕੰਮ 'ਤੇ ਜਾਣਾ ਹੁੰਦਾ ਹੈ ਅਤੇ ਟਰੈਫਿਕ ਇੰਨਾ ਵੱਡਾ ਹੁੰਦਾ ਕਿ ਬੰਦਾ ਲੰਬੇ ਜਾਮ ਵਿੱਚ ਫਸ ਜਾਂਦਾ ਹੈ ਅਤੇ ਆਪਣੇ ਸਮੇਂ 'ਤੇ ਪਹੁੰਚਣ ਤੋਂ ਅਸਮਰਥ ਹੋ ਜਾਂਦਾ ਹੈ ਇਹਦੇ ਨਾਲ ਬਹੁਤ ਹੀ ਸਾਡਾ ਨੁਕਸਾਨ ਹੁੰਦਾ ਹੈ ਅਤੇ ਰਸਤੇ ਵਿੱਚ ਜਦੋਂ ਮੌਸਮ ਖ਼ਰਾਬ ਹੋ ਜਾਂਦਾ ਹੈ ਤਾਂ ਅਸੀਂ ਆਪਣੀ ਬਾਈਕ ਅਤੇ ਬੜੀ ਮੁਸ਼ਕਿਲ ਹੌਲੀ ਹੌਲੀ ਕਰਕੇ ਗੱਡੀ ਚਲਾਉਦੇ ਹਾਂ ਉਹਨੂੰ ਬਾਈਕ ਨੂੰ ਕਿਉਂਕਿ ਗੱਡੀ 'ਚ ਸੜਕ 'ਤੇ ਪਾਣੀ ਬਹੁਤ ਪੈ ਜਾਂਦਾ ਹੈ ਜਿਹਦੇ ਨਾਲ ਸਾਡੀ ਬਾਈਕ ਸਲਿੱਪ ਹੋਣ ਦਾ ਵੀ ਡਰ ਰਹਿੰਦਾ ਹੈ ਇਸ ਕਰਕੇ ਅਤੇ ਕਿਸੇ ਦੂਸਰੇ ਬੰਦੇ ਨੂੰ ਸਾਡੀ ਬਾਈਕ ਦੇ ਪਾਣੀ ਦੀਆਂ ਛਿੱਟਾਂ ਨਾਲ ਨੁਕਸਾਨ ਨਾ ਹੋਵੇ ਇਸ ਕਰਕੇ ਅਸੀਂ ਗੱਡੀ ਹੌਲੀ ਹੌਲੀ ਚਲਾਈ ਦੀ ਹੈ ਅਤੇ ਸਾਡੇ ਆਪਣੇ ਵੀ ਕੱਪੜੇ ਨਾ ਖ਼ਰਾਬ ਹੋਣ ਅਤੇ ਦੂਜੇ ਨੂੰ ਵੀ ਸਾਡੇ ਨਾਲ ਨੁਕਸਾਨ ਨਾ ਹੋਵੇ ਅਤੇ ਸੜਕਾਂ ਦਾ ਹਾਲ ਤਾਂ ਤੁਸੀਂ ਪੁੱਛੋ ਨਾ ਜਦੋਂ ਇਦਾਂ ਦਾ ਮੌਸਮ ਬਣ ਜਾਂਦਾ ਹੈ ਤਾਂ ਸੜਕਾਂ ਆਪੇ ਇੰਨੀਆਂ ਗੰਦੀਆਂ ਹੋ ਜਾਂਦੀਆਂ ਹਨ ਕਿ ਅਸੀਂ ਆਪ ਹੀ ਸੜਕਾਂ ਦੇ ਉੱਤੇ ਬਾਈਕ ਲੈ ਕੇ ਜਾਂਦੇ ਹਾਂ ਤਾਂ ਸਾਡੀ ਬਾਈਕ ਵੀ ਬੜੀ ਗੰਦੀ ਹੋ ਜਾਂਦੀ ਹੈ ਅਤੇ ਉਹਨੂੰ ਧਵਾਉਣ ਵਾਸਤੇ ਬੜੇ ਪੈਸੇ ਲੱਗਦੇ ਹਨ ਸਾਡੇ ਤਾਂ ਸਾਡੀ ਬਾਈਕ ਦਾ ਨੁਕਸਾਨ ਵੀ ਹੁੰਦਾ ਹੈ ਕਿ ਅਸੀਂ ਮੀਂਹ ਦੇ ਮੌਸਮ ਵਿੱਚ ਆਪਣੀ ਬਾਈਕ ਚਲਾਉਦੇ ਹਾਂ ਔਰ ਉਹਨੂੰ ਲੈ ਕੇ ਜਾਂਦੇ ਹਾਂ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਖ਼ਰਾਬ ਮੌਸਮ ਨੂੰ ਛੱਡ ਕੇ ਅਤੇ ਚੰਗੇ ਵੈਦਰ ਵਿੱਚ ਬਿਨਾਂ ਟ੍ਰੈਫਿਕ ਤੋਂ ਅਸੀਂ ਆਪਣੀ ਗੱਡੀ ਲੈ ਕੇ ਜਾਈਏ ਤਾਂ ਅਸੀਂ ਉਹਨੂੰ ਚਲਾਈਏ ਅਤੇ ਜਦੋਂ ਅਸੀਂ ਪਹਾੜੀ ਇਲਾਕੇ ਵਿੱਚ ਜਾਂਦੇ ਹਾਂ ਉੱਥੇ ਵੀ ਦੀਆਂ ਸੜਕਾਂ ਵੀ ਬੜੀਆਂ ਟੇਡੀਆਂ ਮੇਡੀਆਂ ਹਨ ਜਿਹਦੇ ਨਾਲ ਬਹੁਤ ਐਕਸੀਡੈਂਟ ਹੁੰਦੇ ਹਨ ਅਤੇ ਅਸੀਂ ਬਿਲਕੁਲ ਹੌਲੀ ਹੌਲੀ ਕਰਕੇ ਇ ਆਪਣੀ ਬਾਈਕ ਚਲਾਈ ਦੀ ਹੈ ਜਿਹਦੇ ਕਾਰਨ ਸਾਡਾ ਐਕਸੀਡੈਂਟ ਨਾ ਹੋਵੇ ਅਤੇ ਉੱਥੇ ਜੰਗਲੀ ਜਾਨਵਰ ਵੀ ਰਸਤੇ ਵਿੱਚ ਕਦੀ ਕਦਾਰ ਆ ਜਾਂਦੇ ਹਨ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਕਈ ਵਾਰੀ ਅਸੀਂ ਬਾਈਕ ਤੋਂ ਗਿਰ ਵੀ ਜਾਂਦੇ ਹਾਂ ਸਾਡੇ ਸੱਟਾਂ ਵੀ ਲੱਗਦੀਆਂ ਹਨ ਅਤੇ ਅਸੀਂ ਇਸੇ ਕਰਕੇ ਗੱਡੀ ਹੌਲੀ ਚਲਾਈ ਦੀ ਹੈ ਅਤੇ ਸਾਡੀ ਕੋਸ਼ਿਸ਼ ਵੀ ਇਹ ਹੀ ਹੈ ਕਿ ਸਾਰੇ ਬਾਈਕਸ ਹੌਲੀ ਚਲਾਉਣ ਅਤੇ ਉਹਨਾਂ ਦਾ ਐਕਸੀਡੈਂਟ ਨਾ ਹੋਵੇ ਸ਼ੁਕਰੀਆ